ਇਹ ਗੱਲ ਬਿਲਕੁਲ ਸੱਚ ਹੈ ਕਿ ਵਿਗਿਆਨ ਅਤੇ ਤਕਨੀਕੀ ਖੋਜਾਂ ਦੇ ਆਉਣ ਕਾਰਨ ਮਨੁੱਖੀ ਜੀਵਨ ਬਹੁਤ ਹੀ ਅਸਾਨ ਹੋ ਗਿਆ ਹੈ ਪੁਰਾਤਨ ਸਮੇਂ ਵਿੱਚ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਤੁਰ ਕੇ ਜਾਂ ਫਿਰ ਗੱਡੀਆਂ 'ਤੇ ਜਾਂਦੇ ਸਨ ਪਰ ਅੱਜ ਦੇ ਤਕਨੀਕੀ ਆਧੁਨਿਕ ਆਧੁਨਿਕ ਤਕਨੋਲਜੀ ਆਉਣ ਦੇ ਕਾਰਨ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਵਿੱਚ ਮੁਸ਼ਕਲ ਨਹੀਂ ਆਉਂਦੀ ਅੱਜ ਆਵਾਜਾਈ ਦੇ ਸਾਧਨ ਵੱਧ ਗਏ ਹਨ ਅੱਜ ਗੱਡੀਆਂ ਮੋਟਰਾਂ ਕਾਰਾਂ ਇੱਥੋਂ ਤੱਕ ਕਿ ਮੈਟਰੋ ਟ੍ਰੇਨ ਅਤੇ ਹਵਾਈ ਜਹਾਜ਼ ਆ ਗਏ ਹਨ ਜਿਸਦੇ ਕਰਕੇ ਲੋਕ ਅਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਜਾਂਦੇ ਹਨ ਜਿਸਦੇ ਕਰਕੇ ਲੋਕਾਂ ਦਾ ਸਮਾਂ ਵੀ ਬਚਦਾ ਹੈ ਇਸ ਤੋਂ ਇਲਾਵਾ ਇਸ ਟੈਕਨੋਲਜੀ ਨੇ ਬਹੁਤ ਹੀ ਠੱਲ੍ਹ ਪਾਈ ਹੈ ਮਨੁੱਖਾਂ ਦੇ ਜੀਵਨ ਵਿੱਚ ਅੱਜ ਕੱਲ੍ਹ ਇੰਟਰਨੈਟ ਫੋਨ ਅਤੇ ਹੋਰ ਵੀ ਟੈਕਨੋਲੋਜੀ ਆ ਗਈ ਹੈ ਜਿਸਦੇ ਕਰਕੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਅਸਾਨੀ ਹੋ ਗਈ ਹੈ ਬੱਚਿਆਂ ਦੇ ਜੀਵਨ ਵਿੱਚ ਇੰਟਰਨੈਟ ਆਉਣ ਦੇ ਕਰਕੇ ਉਹਨਾਂ ਦੀ ਸਟੱਡੀਜ਼ ਵਿੱਚ ਬਹੁਤ ਮਦਦ ਹੋਈ ਹੈ ਬੱਚੇ ਅੱਜ ਕੱਲ੍ਹ ਔਫਲਾਈਨ ਸਟੱਡੀਜ਼ ਤੋਂ ਇਲਾਵਾ ਔਨਲਾਈਨ ਸਟੱਡੀਜ਼ ਵੀ ਕਰਦੇ ਹਨ ਉਹ ਆਪਣਾ ਟਾਈਮ ਉਹਨੂੰ ਹੋਰ ਜ਼ਿਆਦਾ ਯੂਟੀਲਾਈਜ਼ ਕਰਦੇ ਹਨ ਔਨਲਾਈਨ ਹੋਰ ਵਧੀਆ ਤੋਂ ਵਧੀਆ ਸਕਿੱਲਸ ਸਿੱਖਦੇ ਹਨ ਔਨਲਾਈਨ ਨ ਵਿੱਚ ਸੋਸ਼ਲ ਮੀਡੀਆ ਨਾਲ ਟੱਚ ਵਿੱਚ ਰਹਿੰਦੀਆਂ ਹਨ ਜਿਸ ਤਰ੍ਹਾਂ ਉਹਨਾਂ ਨੂੰ ਸੋਸ਼ਲ ਮੀਡੀਆ ਵਿੱਚ ਕੀ ਹੋ ਰਿਹਾ ਹੈ ਅ ਉਹ ਬਾਰੇ ਸਾਰੀ ਜਾਣਕਾਰੀ ਰਹਿੰਦੀ ਹੈ ਇਸ ਤੋਂ ਇਲਾਵਾ ਟੈਕਨੋਲਜੀ ਆਉਣ ਦੇ ਨਾਲ ਬ ਲੋਕਾਂ ਦੇ ਜੀਵਨ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਉਹਨਾਂ ਦਾ ਸਮੇਂ ਵਿੱਚ ਵੀ ਬਹੁਤ ਫਰਕ ਆਇਆ ਹੈ ਪਹਿਲਾਂ ਨਾਲੋਂ ਹਰ ਕੰਮ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਜਦਕਿ ਅੱਜ ਇੰਟਰਨੈਟ ਆਉਣ ਦੇ ਨਾਲ ਹਰ ਇੱਕ ਕੰਮ ਮਿੰਟਾਂ ਸੈਕਿੰਡਸ ਵਿੱਚ ਹੋ ਜਾਂਦਾ ਹੈ ਲੋਕਾਂ ਨੂੰ ਆਪਣਾ ਕੰਮ ਕਰਨ ਵਾਸਤੇ ਬਹੁਤੀ ਮੁਸ਼ਕਲ ਨਹੀਂ ਕਰਨੀ ਪੈਂਦੀ ਉਹ ਆਪਣਾ ਕੰਮ ਆਧੁਨਿਕ ਟੈਕਨੋਲਜੀਆਂ ਨਾਲ ਬਹੁਤ ਜਲਦੀ ਕਰ ਲੈਂਦੇ ਹਨ ਆਪਣੇ ਕੰਮ ਨੂੰ ਹਰ ਨੇਪਰੇ ਚਾੜ੍ਹਦੇ ਹਨ